ਮੇਰਾ ਨਾਮ ਰੇਹਾਨ ਹੈ ਅਤੇ ਮੈਂ ਚੰਡੀਗੜ੍ਹ ਸ਼ਹਿਰ ਵਿੱਚ ਰਹਿੰਦਾ ਹਾਂ ਮੈਂ ਕੱਲ੍ਹ ਰਾਤ ਹੀ ਟਿਕਟ ਬੁੱਕ ਕਰਵਾਉਣ ਗਿਆ ਸੀ ਇੱਕ ਕੈਫੇ 'ਤੇ ਜਿਸ ਵਿੱਚ ਡੱਬਾ ਨੰਬਰ ਮੇਰਾ ਤਰਵੰਜਾ ਸੋਲ੍ਹਾਂ ਉਣਾਸੀ ਹੈ ਅਤੇ ਸੀਟ ਨੰਬਰ ਚਾਲ੍ਹੀ ਹੈ ਅਤੇ ਕੁਝ ਕਾਰਨਾਂ ਕਰਕੇ ਮੈਨੂੰ ਇਹ ਟਰੇਨ ਮੈਂ ਨਹੀਂ ਜਾ ਸਕਦਾ ਅਤੇ ਮੈਨੂੰ ਅਰਜੈਂਟ ਕੰਮ ਪੈ ਗਿਆ ਹੈ ਮੈਂ ਇਹ ਟਿਕਟ ਆਪਣੀ ਕੱਲ੍ਹ ਦੇ ਦਿਨ ਕਰਵਾਉਣਾ ਚਾਹੁੰਦਾ ਹਾਂ ਕਿਰਪਾ ਕਰਕੇ ਮੇਰੀ ਇਸ ਵਿੱਚ ਸਹਾਇਤਾ ਕੀਤੀ ਜਾਵੇ ਅਤੇ ਮੈਨੂੰ ਦੱਸਿਆ ਜਾ ਸਕੇ ਕਿ ਇਸ ਵਿੱਚ ਤਬਦੀਲੀ ਕੀ ਕੀਤੀ ਜਾਵੇਗੀ ਅਤੇ ਮੈਂ ਬੇਨਤੀ ਕਰਦਾ ਹਾਂ ਕਿ ਇਸ ਵਿੱਚ ਸਹੀ ਡੇਟ ਅਤੇ ਜੇ ਤਰੀਕ ਪਾਈ ਜਾਵੇ ਤਾਂ ਜੋ ਮੈਨੂੰ ਸਹਾਇਤਾ ਮਿਲ ਸਕੇ ਅਤੇ ਤਾਂ ਜੋ ਮੈਂ ਜਿਸ ਦਿਨ ਮੈਂ ਆਪਣੇ ਮੀਟਿੰਗ ਲਈ ਜਾਣਾ ਚਾਹੁੰਦਾ ਹਾਂ ਉਸ ਮੀਟਿੰਗ 'ਤੇ ਮੈਂ ਜਾ ਸਕਾਂ ਅਤੇ ਮੈਨੂੰ ਜੇ ਕਿਸੇ ਆਈ ਡੀ ਪ੍ਰੋਵਾਈਡ ਕੀਤੀ ਜਾਵੇ ਤਾਂ ਜੋ ਮੈਨੂੰ ਟਿਕਟ ਚੈੱਕ ਕਰਵਾਉਣ ਲਈ ਲੋੜੀਂਦੀ ਸੁਵਿਧਾ ਹੋ ਸਕੇ ਅਤੇ ਮੈਨੂੰ ਜ਼ਰੂਰ ਇਹ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਮੈਂ ਕੱਲ੍ਹ ਲਈ ਤਿਆਰ ਹੋ ਸਕਾਂ ਅਤੇ ਮੈਂ ਆਪਣੀ ਟਰੇਨ ਪਕੜ ਸਕਾਂ ਅਤੇ ਮੈਨੂੰ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ